ਹਾਂਜੀ ਨਮਸਤੇ ਜੀ ਮੈਂ ਸੀਮਾ ਦੇਵੀ ਸੁਜਾਨਪੁਰ ਤੋਂ ਬੋਲਦੀ ਹਾਂ ਹਾਂਜੀ ਅੱਜ ਮੈਂ ਤੁਹਾਨੂੰ ਆਪਣੇ ਮਤਲਬ ਕਿ ਫੇਵਰਟ ਮਨੋਰੰਜਨ ਦੇ ਬਾਰੇ ਦੱਸਦੀ ਹਾਂ ਕਿ ਜਿੱਦਾਂ ਕਿ ਮੈਨੂੰ ਸੀਰੀਅਲ ਦੇਖਣਾ ਜਾਂ ਫਿਲਮ ਦੇਖਣਾ ਪਸੰਦ ਹੈ ਅਤੇ ਮੈਂ ਜ਼ਿਆਦਾ ਸੀਰੀਅਲ ਦੇਖਣਾ ਜ਼ਿਆਦਾ ਪਸੰਦ ਕਰਦੀ ਹਾਂ ਜਿੱਦਾਂ ਕਿ ਅਨੁਪਮਾ ਅੱਜ ਕੱਲ੍ਹ ਸੀਰੀਅਲ ਬਹੁਤ ਮਤਲਬ ਕਿ ਲੋਕਪ੍ਰਿਯ ਹੈ ਕਿ ਸਾਰੇ ਲੋਕ ਉਹਨੂੰ ਬੜੇ ਉਤਸ਼ਾਹ ਨਾਲ ਦੇਖਦੇ ਆ ਉਹਦੇ ਵਿੱਚ ਦੱਸਿਆ ਤਾਂ ਗਿਆ ਹੈ ਕਿ ਜਿੱਦਾਂ ਕਿ ਇੱਕ ਲੇਡੀਜ਼ ਔਰਤ ਇੱਕ ਕਿ ਕਿੰਨਾ ਸਟਰਗਲ ਕਰਦੀ ਹੈ ਆਪਣੀ ਜ਼ਿੰਦਗੀ 'ਚ ਆਪਣੇ ਬੱਚਿਆਂ ਦੇ ਪਿੱਛੇ ਆਪਣੇ ਪਰਿਵਾਰ ਦੇ ਪਿੱਛੇ ਅਤੇ ਮਤਲਬ ਕਿ ਹਰ ਤੂਫਾਨ ਤੋਂ ਗੁਜ਼ਰਦੀ ਆ ਉਹ ਹਰ ਮੁਸ਼ਕਲ ਤੋਂ ਗੁਜ਼ਰਦੀ ਆ ਉਹ ਆਪਣੇ ਬੱਚਿਆਂ ਦੇ ਵਾਸਤੇ ਵੀ ਹਰ ਮੁਸ਼ਕਲ ਤੋਂ ਗੁਜ਼ਰਦੀ ਹੈ ਪਰ ਉਸ ਲੇਡੀਸ ਨੂੰ ਸਮਝਣ ਵਾਲਾ ਕੋਈ ਨਹੀਂ ਹੁੰਦਾ ਇਸ ਕਰਕੇ ਮੈਨੂੰ ਉਹ ਸੀਰੀਅਲ ਬਹੁਤ ਜ਼ਿਆਦਾ ਪਸੰਦ ਆਇਆ ਕਿ ਇੱਕ ਮਾਂ ਆਪਣੇ ਬੱਚਿਆਂ ਵਾਸਤੇ ਕੀ ਕੁਛ ਨਹੀਂ ਕਰਦੀ ਔਰ ਉਸਦੇ ਕੱਪੜੇ ਪਾਉਣ ਦਾ ਤਰੀਕਾ ਵੀ ਮੈਨੂੰ ਬਹੁਤ ਅੱਛਾ ਲੱਗਦਾ ਹੈ ਅਤੇ ਉਹ ਲੇਡੀਜ਼ ਵੀ ਆਪਣੇ ਪਰਿਵਾਰ ਵਾਸਤੇ ਬਹੁਤ ਕੁਛ ਕਰਦੀ ਹੈ ਔਰ ਇਸ ਦੇਸ਼ ਦੇ ਰਹਿੰਦੇ ਹੋਏ ਵੀ ਉਹ ਅਮੇਰਿਕਾ ਜਾ ਕੇ ਬਹੁਤ ਮਤਲਬ ਕਿ ਬੁਰੀ ਬੁਰੀ ਤਰ੍ਹਾਂ ਫਸ ਜਾਂਦੀ ਹੈ ਕਿ ਜਦੋਂ ਇਹ ਸਟਰਗਲ ਕਰਦੀ ਹੈ ਅਤੇ ਉਹ ਆਪਣੀ ਹਿੰਮਤ ਦੇ ਹੀ ਕਾਰਨ ਉਸ ਸਟਰਗਲ ਮੁਸ਼ਕਲ ਤੋਂ ਬਾਹਰ ਨਿਕਲਦੀ ਹੈ ਇਸ ਕਰਕੇ ਮੈਨੂੰ ਉਹ ਲੇਡੀਜ ਬਹੁਤ ਪਸੰਦ ਹੈ ਕਿ ਇੱਕ ਔਰਤ ਓ ਹੋਣ ਦੇ ਬਾਵਜੂਦ ਵੀ ਉਹ ਹਰ ਮੁਸ਼ਕਲ ਦਾ ਸਾਹਮਣਾ ਕਰਦੀ ਹੈ ਕਿਉਂਕਿ ਇੱਕ ਔਰਤ ਚਾਹੇ ਤਾਂ ਕੁਛ ਵੀ ਕਰ ਸਕਦੀ ਹੈ ਆਪਣੀ ਹਿੰਮਤ ਦੇ ਬਾਵਜੂਦ ਵੀ ਉਹ ਹਰ ਮੁਸ਼ਕਲ ਨੂੰ ਪਾਰ ਕਰ ਸਕਦੀ ਹੈ ਇਸ ਕਰਕੇ ਮੈਨੂੰ ਅਨੁਪਮਾ ਸੀਰੀਅਲ ਬਹੁਤ ਜ਼ਿਆਦਾ ਸੁੰਦਰ ਲੱਗਦਾ ਹੈ ਕਿ ਉਹਦੇ ਵਿੱਚ ਇੱਕ ਲੇਡੀ ਦੇ ਬਾਰੇ ਸਭ ਕੁਝ ਦੱਸਿਆ ਗਿਆ ਧੰਨਵਾਦ ਜੀ